ਹਾਂਜੀ ਹਾਂਜੀ ਅਸੀਂ ਯੋਗਾ ਓਨਲਾਈਨ ਕੋਚਿੰਗ ਦਿੰਦੇ ਹਾਂ ਹਾਂਜੀ ਤੁਸੀਂ ਤੁਸੀਂ ਕੀ ਪੁੱਛਣਾ ਹੈ ਅੱਛਾ ਅੱਛਾ ਤੁਸੀਂ ਕੀ ਤੁਸੀਂ ਕਿਸੇ ਯੋਗਾ ਬਾਰੇ ਲੈਣੇ ਚਾਹੁੰਦੇ ਹੋ ਤੁਹਾਨੂੰ ਤਕਲੀਫ ਕੀ ਹੈਗੀ ਹੈ ਅੱਛਾ ਘੁਟਨਿਆਂ ਦੀ ਅਤੇ ਬੇਕ ਪੇਨ ਦੀ ਹੈਗੀ ਹੈ ਅੱਛਾ ਅਤੇ ਤੁਸੀਂ ਕਿੰਨੇ ਟਾਈਮ ਲਈ ਪਰਚੇਸ ਕਰਨਾ ਹੈ ਹੈਲੋ ਹੈਲੋ ਤੁਹਾਡੀ ਆਵਾਜ਼ ਨਹੀਂ ਆ ਰਹੀ ਹੈਲੋ ਤੁਹਾਡੀ ਆਵਾਜ਼ ਨਹੀਂ ਆ ਰਹੀ ਹੈਲੋ ਹਾਂਜੀ ਤੁਸੀਂ ਕਿੰਨੇ ਟਾਈਮ ਲਈ ਲੈਣੀ ਹੈ ਹਾਂ ਹਾਂ ਅੱਛਾ ਠੀਕ ਹੈ ਤੁਸੀਂ ਮਤਲਬ ਮੋਰਨਿੰਗ ਜਾਂ ਈਵਨਿੰਗ ਦੋਨੋ ਟਾਈਮ 'ਤੇ ਫ੍ਰੀ ਹੈਗੇ ਹੋ ਠੀਕ ਹੈ ਤੇ ਅਤੇ ਤੁਹਾਨੂੰ ਅਸੀਂ ਇਹ ਪੂਰਾ ਕੋਰਸ ਦੇਵਾਂਗੇ ਅਤੇ ਇਹਦੇ ਵਿੱਚ ਤੁਹਾਡੇ ਗੋਡਿਆਂ ਦਾ ਅਤੇ ਇਹ ਬੇਕ ਪੇਨ ਦੀ ਇਹ ਸਮੱਸਿਆਂ ਨਾਈਨਟੀ ਪਰਸੈਂਟ ਤੁਹਾਡੀ ਇਸ ਨਾਲ ਹੱਲ ਹੋ ਸਕਦੀ ਹੈ ਅਸੀਂ ਪੂਰੀ ਗਾਰੰਟੀ ਤਾਂ ਨਹੀਂ ਦੇ ਸਕਦੇ ਤੁਹਾਨੂੰ ਹਾਂਜੀ ਅਤੇ ਹਾਂਜੀ ਨਹੀਂ ਤੁਸੀਂ ਤਾਂ ਓਨਲਾਈਨ ਲੈਣੀ ਹੈ ਨਾ ਫਿਰ ਇਹਦੇ ਵਿੱਚ ਮਿਲਣ ਦਾ ਤਾਂ ਕੁਝ ਹਾਂਜੀ ਤੁਸੀਂ ਤੁਸੀਂ ਓਨਲਾਈਨ ਲੈਣੀ ਹੈ ਨਾ ਅਤੇ ਅਸੀਂ ਓਨਲਾਈਨ ਤੁਹਾਨੂੰ ਕੋਰਸ ਪਰਚੇਸ ਕਰਵਾ ਦੇਵਾਂਗੇ ਉਹ ਤੁਸੀਂ ਵੇਖੋ ਵੀ ਤੁਸੀਂ ਕਿਹੜੇ ਟਾਈਮ ਜੋਇਨਿੰਗ ਕਰਨਾ ਹੈ ਕਿਹੜੇ ਟਾਈਮ ਨਹੀਂ ਕਰਨਾ ਹਾਂਜੀ ਹੂੰ ਠੀਕ ਹੈ